ਸਰ ਮੈਂ ਦੇਸਰਾਜ ਬੋਲਦਾ ਹਾਂ ਪਿੰਡ ਭੂਲਚੱਕ ਢੇਸੀਆਂ ਰਹਿਣ ਵਾਲਾ ਪਠਾਨਕੋਟ ਸਤਿ ਸ਼੍ਰੀ ਅਕਾਲ ਸਰ ਸਰ ਮੈਨੂੰ ਯੋਗਾ ਕਰਨਾ ਬਹੁਤ ਹੀ ਪਸੰਦ ਹੈ ਇਸ ਕਰਕੇ ਮੈਂ ਛੋਟੀ ਉਮਰ ਵਿੱਚ ਪੰਦਰ੍ਹਾਂ ਸਾਲ ਦੀ ਉਮਰ ਦੇ ਵਿੱਚ ਹੀ ਯੋਗਾ ਮੇਰੇ ਘਰਦਿਆਂ ਨੇ ਸਿਖਾਤਾ ਇਸ ਕਰਕੇ ਯੋਗਾ ਕਰਨ ਨਾਲ ਸਾਨੂੰ ਕਈ ਬਿਮਾਰੀਆਂ ਦੂਰ ਹੁੰਦੀਆਂ ਨਾ ਸ਼ੂਗਰ ਦਾ ਮਰੀਜ਼ ਹੋ ਸਕਦਾ ਨਾ ਬੱਡ ਪ੍ਰੈਸ਼ਨ ਦਾ ਮਰੀਜ਼ ਹੋ ਸਕਦਾ ਸਾਨੂੰ ਇਸ 'ਤੇ ਸਾਡੀਆਂ ਸਰੀਰ ਦੀਆਂ ਮਾਸਪੇਸ਼ੀਆਂ ਬਿਲਕੁਲ ਹੀ ਠੀਕ ਠਾਕ ਰਹਿੰਦੀਆਂ ਸਾਡੇ ਸਰੀਰ ਦੀ ਪਾਚਨ ਕਿਰਿਆ ਵੀ ਬਿਲਕੁਲ ਸਹੀ ਰਹਿੰਦੀ ਹੈ ਸਾਡੇ ਪਿੰਡ ਵਿੱਚ ਇੱਕ ਇੱਕ ਨਹਿ ਨਹਿਰੀ ਪਿੰਡ ਹੈ ਅਸੀਂ ਸਵੇਰੇ ਔਰ ਸ਼ਾਮ ਨੂੰ ਨਦੀ ਦੇ ਕਿਨਾਰੇ ਯੋਗਾ ਕਰਨ ਚੱਲ ਜਾਂਦੇ ਹਾਂ ਇਸ ਕਰਕੇ ਸਾਨੂੰ ਠੰਡੀ ਔਰ ਤਾਜ਼ੀ ਹਵਾ ਯੋਗੇ ਵਾਸਤੇ ਬਹੁਤ ਹੀ ਲੈਣੀ ਜ਼ਰੂਰੀ ਹੈ ਸਾਡੇ ਸਰੀਰ ਦੀਆਂ ਜਿਹੜੀਆਂ ਮਾਸਪੇਸ਼ੀਆਂ ਵੀ ਬਿਲਕੁਲ ਸਹੀ ਰਹਿੰਦੀਆਂ ਹੀ ਇਸ ਕਾਰਨ ਸਾਨੂੰ ਯੋਗਾ ਕਰਨਾ ਬਹੁਤ ਹੀ ਸਰੀਰ ਲਈ ਲਾਭਦਾਇਕ ਹੈ ਇਸ ਕਰਕੇ ਸਾਨੂੰ ਯੋਗਾ ਕਰਨਾ ਛੋਟੀ ਉਮਰ ਵਿੱਚ ਬਹੁਤ ਹੀ ਜ਼ਰੂਰੀ ਹੈ ਇਸ ਕਰ